ਟੈਕਨੋਲਜੀ ਨੇ ਸਿੱਖਿਆ ਉਦੋਗ ਵਿੱਚ ਬਹੁਤ ਮਦਦ ਕੀਤੀ ਹੈ ਯੂਟੀਊਬ ਤੇ ਵੀਡੀਓ ਆਉਂਦੀਆਂ ਵਿਦਿਆਰਥੀਆਂ ਲਈ ਪੜ੍ਹਨਾ ਸੌਖਾ ਹੋ ਗਿਆ ਹੈ ਜਿਵੇਂ ਅਸੀਂ ਦੇਖਦੇ ਹਾਂ ਅਸੀਂ ਕੋਈ ਵੀ ਕਲਾਸ ਲਾਣੀ ਹੁੰਦੀ ਆ ਪੜ੍ਹਨ ਵੇਲੇ ਸਾਨੂੰ ਕਿਤੇ ਆਲੇ ਦੁਆਲੇ ਡਾਟਾ ਨਹੀਂ ਮਿਲਦਾ ਅਸੀਂ ਸਿੱਧੇ ਜਾ ਕੇ ਯੂਟਿਊਬ ਤੇ ਸਰਚ ਕਰਦੇ ਹਨ ਉਸ ਟੋਪਿਕ ਰਿਲੇਟਿਡ ਕਾਫੀ ਵੀਡੀਓ ਮਿਲ ਜਾਂਦੀਆਂ ਹਨ ਜਿਨਾਂ ਨੇ ਸਾਨੂੰ ਪੜ੍ਹਨ ਵਿੱਚ ਵੀ ਆਸਾਨ ਮਿਲਦਾ ਹੈ ਅਸੀਂ ਆਨਲਾਈਨ ਕੋਰਸ ਵੀ ਲੈ ਸਕਦੇ ਆ ਅਸੀਂ ਜਦੋਂ ਵੈਸੇ ਜਦੋਂ ਅਸੀਂ ਬਾਏ ਫਿਜੀਕਲ ਜਾ ਕੇ ਕੋਈ ਆਪਣਾ ਉਹ ਕਲਾਸ ਲੈਂਦੇ ਆ ਉਹ ਸਾਨੂੰ ਕਾਫੀ ਮਹਿੰਗੀ ਪੈਂਦੀ ਹੈ ਜਦੋਂ ਅਸੀਂ ਔਨਲਾਈਨ ਕੋਈ ਆਪਣਾ ਕੋਰਸ ਬਾਏ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜੇ ਸਾਨੂੰ ਦੂਜੀ ਤਰਾਂ ਉਹ ਕਲਾਸ ਮਨ ਲੋ ਤਿੰਨ ਸੋ ਨੂੰ ਕੋਰਸ ਤਿੰਨ ਹਜਾਰ ਨੂੰ ਕੋਰਸ ਮਿਲਦਾ ਏ ਤਾਂ ਸਾਨੂੰ ਇਹ ਕੋਰਸ ਸਾਨੂੰ ਜਿਹੜਾ ਆਨਲਾਈਨ ਹੈਗਾ ਉਹ ਸਾਨੂੰ ਨੋ ਸੋ ਰੁਪਏ ਨੋ ਸੋ ਨੜਿਨਵੇਂ ਰੁਪਏ ਚ ਉਹ ਓਵਰਾਂ ਵਿੱਚ ਪ੍ਰਾਪਤ ਹੋ ਜਾਂਦਾ ਤੇ ਜਿਹਦੇ ਨਾਲ ਸਾਨੂੰ ਫਾਇਦਾ ਇਹ ਮਿਲਦਾ ਸੀ ਆਨਲਾਈਨ ਕੋਰਸ ਲੈਂਦੇ ਆ ਪੜਾਈ ਲਈ ਅਸੀਂ ਉਹਨੂੰ ਵਾਰ ਵਾਰ ਰਿਪੀਟ ਵੀ ਕਰ ਸਕਦੇ ਆਂ ਵੀ ਸਾਨੂੰ ਪਹਿਲੀ ਵਾਰ ਨਹੀਂ ਸਮਝ ਆਦਾ ਤਾਂ ਅਸੀਂ ਦੁਬਾਰਾ ਫੇਰ ਦੇਖ ਸਕਦੇ ਆਂ ਅਸੀਂ ਤੀਜੀ ਵਾਰ ਦੇਖ ਸਕਦੇ ਆਂ ਇਹਦੇ ਨਾਲ ਅਸੀਂ ਆਨਲਾਈਨ ਕਾਫੀ ਸਹੂਲਤਾਂ ਸਾਨੂੰ ਮਿਲ ਜਾਣਾ ਤੁਸੀਂ ਆਨਲਾਈਨ ਦਾਖਲੇ ਦੀ ਗੱਲ ਲੈ ਲਓ ਅਸੀਂ ਕਿਸੇ ਵੀ ਮਾਲਿਕ ਕਾਲਜ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਹੋਵੇ ਤਾਂ ਅਸੀਂ ਔਨਲਾਈਨ ਉਹਦੀ ਸਾਈਡ ਤੇ ਜਾ ਕੇ ਆਪਣਾ ਦਾਖਲਾ ਬਾਇਓਡਾਟਾ ਸਾਰਾ ਭਰ ਕੇ ਅਸੀਂ ਦਾਖਲਾ ਲੈ ਲੈਂਦੇ ਆਂ ਤਾਂ ਜੋ ਸਾਡਾ ਆਣ ਜਾਣ ਦਾ ਖਰਚਾ ਹੀ ਵੱਧ ਜਾਂਦਾ ਤੇ ਸਾਨੂੰ ਹੋਰ ਸਹੂਲਤਾਂ ਕਾਫੀ ਮਿਲ ਜਾਂਦੀਆਂ ਤੇ ਘਰੀਂ ਬੈਠੇ ਸਾਨੂੰ ਕਾਫੀ ਜਾਣਕਾਰੀ ਇਕੱਠੀ ਹੋ ਜਾਂਦੀ ਆ ਤੇ ਸਾਡੇ ਕੋਲ ਇੰਟਰਨੈਸ਼ਨਲ ਕਨੈਕਸ਼ਨ ਹੈ ਇਹ ਤਾਂ ਹੀ ਸਾਰਾ ਕੁਝ ਸੰਭਵ ਹੈ ਅੱਜ ਦੇ ਜਮਾਨੇ ਵਿੱਚ ਸਮੇਂ ਦੇ ਨਾਲ ਤਾਲਮੇਲ ਰੱਖਣਾ ਬੇਹਦ ਮੁਸ਼ਕਿਲ ਹੁੰਦਾ ਜਾ ਰਿਹਾ ਪਰ ਆਨਲਾਈਨ ਕੋਰਸਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭਦਾਇਕ ਹੁੰਦਾ ਪੜਾਈ ਲਈ ਉਦੇਸ਼ਾਂ ਲਈ ਸਕੂਲ ਕਾਲਜ ਯੂਨੀਵਰਸਿਟੀ ਜਾਣ ਲਈ ਦਰਦ ਲੈਣ ਦੀ ਜਰੂਰਤ ਨਹੀਂ ਹੁੰਦੀ ਇੰਟਰਨੈਟ ਰਾਹੀਂ ਲਾਈਵ ਕਲਾਸਾਂ ਹੀ ਲਗਾਇਆ ਜਾ ਸਕਦੀਆਂ ਹਨ ਇੱਕ ਵਿਦਿਆਰਥੀ ਜੀਵਨ ਪੱਤਾ ਇੰਟਰਨੈਟ ਦੇ ਆਨਲਾਈਨ ਟੈਕਨੋਲੋਜੀ ਜਿਹੜੀ ਹ ਬਹੁਤ ਪ੍ਰਭਾਵ ਪਾ ਦੇ ਨਾ ਬਹੁਤ ਜਿਆਦਾ ਸਹੂਲਤਾਂ ਪ੍ਰਦਾਨ ਹੁੰਦੀਆਂ ਹਨ